ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਿੰਦਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਇੱਥੇ ਦਾ ਇਤਿਹਾਸ ਹੈ ਜੋ ਦੁਨੀਆ ਦੀ ਮਹਿੰਗੀ ਵਰਲਡ ਦੀ ਮਹਿੰਗੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜਿਸ ਦਾ ਕੋਈ ਵੀ ਮੁੱਲ ਨਹੀਂ ਨਾ ਲੱਗਿਆ ਅਤੇ ਨਾ ਹੀ ਅੱਗੇ ਰਹਿੰਦੀ ਦੁਨੀਆਂ ਤੱਕ ਲੱਗੇਗਾ ਦਿਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਜਗ੍ਹਾ ਮੁੱਲ ਖਰੀਦੀ ਸੀ ਜੋ ਕਿ ਜੋਤੀ ਸਰੂਪ ਸਾਹਿਬ ਹੈ ਜਿਨ੍ਹਾਂ ਦੀ ਸ਼ਹੀਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੋਈ ਸੀ ਇਥੇ ਜਿੱਥੇ ਜਦੋਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਸੀ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਕੋਹਲੂ 'ਚ ਸਾਰਾ ਪਰਿਵਾਰ ਪੀੜਤਾ ਸੀ ਉਹਨਾਂ ਦਾ ਗੁਰਦੁਆਰਾ ਉੱਥੇ ਜਿਹੜੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਉਹ ਗਲਾਸ ਵੀ ਹੈਗੇ ਨੇ ਜੀ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਠੀਕ ਹੈ ਜੀ ਅਤੇ ਨਾਲ ਹੀ ਇੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਉਪਰਲੇ ਪਾਸੇ ਠੰਡਾ ਬੁਰਜ ਆ ਜਿੱਥੇ ਉਹਨਾਂ ਨੂੰ ਕੈਦ ਕੀਤਾ ਸੀ ਉਹ ਨਾਲ ਆ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਜੀ ਦਾ ਪਰੇ ਹੈ ਇਕ ਦਿਵਾਨ ਟੋਡਰ ਮੱਲ ਦੀ ਹਵੇਲੀ ਹੈ ਉਹ ਬਿਲਕੁਲ ਰੇਲਵੇ ਫਾਟਕ ਟੱਪ ਕੇ ਖੱਬੇ ਹੱਥ ਜਾ ਕੇ ਥੋੜ੍ਹੀ ਜਿਹੀ ਦੂਰੀ 'ਤੇ ਹੈ ਜੀ ਹਾਂਜੀ ਆਮ ਖਾਸ ਬਾਗ ਵੀ ਹੈਗਾ ਜੀ ਉਹ ਸਰਹਿੰਦ ਸ਼ਹਿਰ ਤੋਂ ਥੋੜ੍ਹਾ ਜਿਹਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਅਤੇ ਵਿਚਾਲੇ ਪੈਂਦਾ ਆਮ ਕਰਕੇ ਹੁਣ ਉੱਥੇ ਬਾਗ ਨੇ ਜਾਂ ਤਾਂ ਪੁਰਾਣੀਆਂ ਜਿਹੜੀਆਂ ਇਮਾਰਤਾਂ ਉਹ ਹੈਗੀਆਂ ਨੇ ਉੱਥੇ ਫਿਲਮਾਂ ਦੀਆਂ ਸ਼ੂਟਿੰਗ ਸ਼ੂਟਿੰਗ ਵਗੈਰਾ ਅਤੇ ਗਾਣਿਆਂ ਦੀਆਂ ਸ਼ੂਟਿੰਗ ਵਗੈਰਾ ਜਾਂ ਆਮ ਰੂਟੀਨ 'ਚ ਲੋਕ ਉੱਥੇ ਸੈਰ ਕਰਨ ਵੀ ਆਉਂਦੇ ਨੇ ਅਤੇ ਉੱਥੇ ਘੁੰਮਣ ਵੀ ਜਾ ਆਉਂਦੇ ਨੇ ਜੀ ਲੋਕ ਆਉਂਦੇ ਨੇ ਅਤੇ ਆਪਣੇ ਪਿੱਟ ਵਗੈਰਾ ਕਰਕੇ ਜਾਂ ਕੋਈ ਵੀਡੀਓਗ੍ਰਾਫੀ ਹੋ ਗਈ ਜਾਂ ਮੈਰਿਜ ਦੀ ਇਨਵਰਸਰੀਆਂ ਹੋ ਗਈਆਂ ਉਹ ਮਤਲਬ ਉੱਥੇ ਵੀ ਵੀਡੀਓ ਸ਼ੂਟ ਕਰਕੇ ਵੀ ਜਾਂਦੇ ਨੇ ਜੀ ਹਾਂਜੀ

ਤੁਸੀਂ ਉੱਥੋਂ ਮੇਨ ਘਰ ਤੋਂ ਜਦੋਂ ਬਾਹਰ ਨਿਕਲੋਗੇ ਆਟੋ ਲਓ ਜੀ ਆਟੋ ਨੇ ਹੀ ਤੁਹਾਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਛੱਡ ਦੇਣਾ ਆਟੋ ਨੇ ਹੀ ਤੁਹਾਨੂੰ ਜੋਤੀ ਸਰੂਪ ਛੱਡ ਦੇਣਾ ਆਟੋ ਨੇ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਛੱਡ ਦੇਣਾ ਆਟੋ ਨੇ ਹੀ ਤੁਹਾਨੂੰ ਆਪਣਾ ਜਿਹੜਾ ਪੈਂਦਾ ਜੀ ਆਮ ਖਾਸ ਬਾਗ ਉੱਥੇ ਮਤਲਬ ਜਿਹੜੀ ਸਰਹੰਦ ਸ਼ਹਿਰ ਦੇ ਵਿੱਚੋਂ ਜਿਹੜਾ ਪ੍ਰੋਵਾਈਡ ਆਟੋ ਸਾਰਿਆਂ ਨੂੰ ਬੈਸਟ ਆ ਜੀ ਅੱਜ ਦੇ ਲਈ ਅਤੇ ਛੋਟੇ ਆਪਣੇ ਬਜ਼ਾਰ ਦੇ ਲਈ ਲੋਕਲ ਲਈ ਓਕੇ ਜੀ ਸਤਿ ਸ਼੍ਰੀ ਅਕਾਲ ਜੀ